ਬਹੁਤ ਸਾਰੇ ਲੋਕ ਪੋਲਟਰੀ ਫਾਰਮ ਖੋਲ੍ਹਦੇ ਹਨ ਖਾਸ ਕਰਕੇ ਕਿਸਾਨਾਂ ਨੂੰ ਪੋ ਪੋਲਟੀ ਫਾਰਮ ਖੋਲ੍ਹਣ ਦਾ ਬੜਾ ਸ਼ੌਕ ਹੁੰਦਾ ਹੈ ਉਹ ਕਿਤੇ ਅਲੱਗ ਜਗ੍ਹਾ ਲੈ ਕੇ ਪੋਲਟਰੀ ਫਾਰਮ ਖੋਲ੍ਹਦੇ ਹਨ ਅਤੇ ਉਹ ਉਹਨਾਂ ਵਾਸਤੇ ਦਾਣਾ ਵਧੀਆ ਰੱਖਦੇ ਹਨ ਅਤੇ ਡਾਕਟਰ ਵੀ ਰੱਖੇ ਹੁੰਦੇ ਹਨ ਉਹ ਸਮੇਂ ਸਮੇਂ 'ਤੇ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਕਰਦੇ ਹਨ ਅਤੇ ਉਹ ਖੁੱਲ੍ਹੀ ਜਗ੍ਹਾ 'ਤੇ ਬਾਹਰ ਖੋਲ੍ਹਦੇ ਹਨ ਪੋਲਟਰੀ ਫਾਰਮ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਜਾਨਵਰ ਤਾਂ ਉਸਦਾ ਜਲਦੀ ਤੋਂ ਜਲਦੀ ਇਲਾਜ ਕਰਵਾਉਂਦੇ ਹਾਂ ਉਹਨਾਂ ਨੂੰ ਬਹੁਤ ਕਮਾਈ ਹੁੰਦੀ ਹੈ ਆਂਡੇ ਮੀਟ ਉਹ ਅੰਡੇ ਮੀਟ ਵੇਚ ਸਕਦੇ ਹਨ ਅਤੇ ਯੂਟੀਊਬ ਤੋਂ ਜਾਂ ਅਖਬਾਰਾਂ 'ਚੋਂ ਉਸਦੇ ਬਾਰੇ ਬਹੁਤ ਕੁਝ ਵੇਖਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਉਹਨਾਂ ਤੋਂ ਬਹੁਤ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਇਹ ਰੱਖੇ ਜਾ ਸਕਦੇ ਹਨ ਇਹ ਇਹ ਬਣਾਉਣ ਦਾ ਬਹੁਤ ਫਾਇਦਾ ਹੁੰਦਾ ਹੈ ਪੋਲਟਰੀ ਫਾਰਮ ਇਹਦੇ ਵਿੱਚ ਕਾਫੀ ਸਾਰੇ ਜਾਨਵਰ ਰੱਖੇ ਜਾ ਸਕਦੇ ਆ ਪਰ ਅਲੱਗ ਅਲੱਗ ਰੱਖਣ 'ਤੇ ਉਹਨਾਂ ਦਾ ਬਹੁਤ ਫਾਇਦਾ ਹੁੰਦਾ ਹੈ ਇੱਕ ਤਾਂ ਉਹ ਬਿਮਾਰ ਜ਼ਿਆਦਾ ਨਹੀਂ ਹੁੰਦੇ ਅਗਰ ਸਾਫ ਉਹਨਾਂ ਨੂੰ ਖਾਣਾ ਦਿੱਤਾ ਜਾਵੇ